ਨਹੀਂ ਮੈਂ ਵੀਡਿਓ ਗੇਮਸ ਬਾਰੇ ਨਹੀਂ ਜਾਣਦੀ ਕਿਉਂਕਿ ਮੈਂ ਜ਼ਿਆਦਾ ਵੀਡਿਓ ਗੇਮਸ ਨਹੀਂ ਖੇਡੀਆਂ ਅਤੇ ਮੈਨੂੰ ਇਹ ਖੇਡਣਾ ਪਸੰਦ ਵੀ ਨਹੀਂ